ਹਾਂਜੀ ਮੈਂ ਜਾਣਦੀ ਹਾਂ ਜਿਸ ਕੋਲ ਕਾਲਜ ਦੀ ਡਿਗਰੀ ਹੈ ਉਹ ਮੇਰੇ ਨੇ ਹਸਬੈਂਡ ਮੇਰੇ ਹਸਬੈਂਡ ਨੇ ਪਹਿਲਾ ਮਕੈਨਿਕਲ ਇ ਡਿਪਲੋਮਾ ਕੀਤਾ ਜੋ ਕਿ ਜੀ ਐੱਨ ਈ ਕੋਲਜ ਲੁਧਿਆਣਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੰਜੀਨੀਰਿੰਗ ਕੀਤੀ ਮਕੈਨੀਕਲ ਫੀਲਡ ਵਿੱਚ ਦੈਨ ਉਹ ਹੁਣ ਕੰਟੀਨਿਊ ਕਰ ਰਹੇ ਨੇ ਆਪਣੀ ਪੀ ਐੱਚ ਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅਤੇ ਪੀ ਐੱਚ ਡੀ ਦੇ ਨਾਲ ਨਾਲ ਜੋਬ ਕਰ ਰਹੇ ਨੇ ਉਹ ਜੋ ਕਿ ਮੇਰੇ ਲਈ ਬਹੁਤ ਪ੍ਰੇਰਣਾ ਮਿਲਦੀ ਹੈ ਮੈਨੂੰ ਇਹ ਸਭ ਦੇਖ ਕੇ ਉਹਨਾਂ ਨੇ ਪੀ ਐੱਚ ਡੀ ਸਟਾਰਟ ਕੀਤੀ ਹੈ ਉਹ ਬਹੁਤ ਇੰਟਰਸਟਿਡ ਨੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਲੈਣ ਵਿੱਚ ਸਟੱਡੀ ਵਿੱਚ ਸ਼ੁਰੂ ਤੋਂ ਹੀ ਉਹਨਾਂ ਦਾ ਬਹੁਤ ਇੰਟਰਸਟ ਰਿਹਾ ਹੈ ਬਹੁਤ ਮੈਨੂੰ ਉਹਨਾਂ ਨੂੰ ਵੇਖ ਕੇ ਪ੍ਰੇਰਣਾ ਮਿਲਦੀ ਹੈ ਜੋਬ ਦੇ ਨਾਲ ਨਾਲ ਪੜ੍ਹਨਾ ਇੱਕ ਬਹੁਤ ਵੱਡੀ ਗੱਲ ਹੈ ਉਹ ਵੀ ਆਫਟਰ ਟੂ ਕਿਡਸ ਅਤੇ ਉਹਨਾਂ ਕੋਲ ਆਪਾਂ ਕਹਿ ਸਕਦੇ ਆ ਤਿੰਨ ਕਾਲਜ ਦੀਆਂ ਡਿਗਰੀਆਂ ਹੋ ਜਾਣਗੀਆਂ ਜਦੋਂ ਉਹ ਆਪਣੀ ਪੀ ਐੱਚ ਡੀ ਕੰਪਲੀਟ ਕਰ ਦੇਣਗੇ ਅਤੇ ਇਸ ਨਾਲ ਇਹ ਹੈ ਕਿ ਡਿਗਰੀਆਂ ਲੈ ਕੇ ਆਪਾਂ ਆਪਣਾ ਜੀਵਨ ਸਫਲ ਕਰ ਸਕਦੇ ਨੇ ਆਪਣਾ ਲਿਵਿੰਗ ਲਾਈਫ ਸਟਾਈਲ ਇੱਕ ਚੰਗੀ ਐਜੂਕੇਸ਼ਨ ਨਾਲ ਆਪਾਂ ਲਿਆ ਸਕਦੇ ਨੇ ਵਧੀਆ ਅਤੇ ਲਾਈਫ ਸਟਾਈਲ ਨਾਲ ਆਪਾਂ ਇੰਪਰੂਵਮੈਂਟ ਸਿਰਫ ਇੱਕ ਐਜੂਕੇਸ਼ਨ ਨਾਲ ਲਿਆ ਸਕਦੇ ਨੇ ਇੱਕ ਆਪਾਂ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇ ਸਕਦੇ ਨੇ ਚੰਗੀ ਜੋਬ ਲੈ ਕੇ ਚੰਗੀ ਐਜੂਕੇਸ਼ਨ ਲੈ ਕੇ ਚੰਗੀ ਡਿਗਰੀ ਲੈ ਕੇ